ਸਲਾਨਾ ਯਾਤਰਾ ਦੇ ਵਿੱਚ ਸਾਡੇ ਸ਼੍ਰੀ ਚਮਕੌਰ ਸਾਹਿਬ ਵਿਖੇ ਹੈ ਨਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਹੜਾ ਕਿ ਸ਼੍ਰੀ ਗੋਬਿੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਹੈ ਨਾ ਅਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਹੈ ਨਾ ਉੱਥੇ ਅਫਸੋਸ ਦੇ ਤੌਰ 'ਤੇ ਲੋਕ ਜਾਂਦੇ ਆ ਅਤੇ ਉਨ੍ਹਾਂ ਨੂੰ ਯਾਦ ਕਰਦੇ ਆ ਕਿੱਦਾਂ ਉਹਨਾਂ ਨੇ ਸਾਡੇ ਵਾਸਤੇ ਸ਼ਹੀਦੀਆਂ ਪਾਈਆਂ ਹੈ ਨਾ ਅਤੇ ਹੈ ਨਾ ਉਨ੍ਹਾਂ ਦੀ ਯਾਦ ਦੇ ਵਿੱਚ ਉੱਥੇ ਨਗਰ ਕੀਰਤਨ ਕੱਢੇ ਜਾਂਦੇ ਆ ਅਤੇ ਤਿੰਨ ਦਿਨ ਦਾ ਸ਼ਹੀਦੀ ਜੋੜ ਮੇਲਾ ਉੱਥੇ ਲੱਗਦਾ ਏ ਅਤੇ ਅਤੇ ਲੋਕ ਹੈ ਨਾ ਹੁੰਮ ਹੁੰਮਾ ਕੇ ਬਹੁਤ ਸਾਰੀਆਂ ਜਗ੍ਹਾ ਤੋਂ ਇੱਥੇ ਹੈ ਨਾ ਸ਼ਹੀਦਾਂ ਨੂੰ ਯਾਦ ਕਰਨ ਆਉਂਦੇ ਆ ਅਤੇ ਸ਼੍ਰੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿੱਖੇ ਹੈ ਨਾ ਮੱਥਾ ਟੇਕਦੇ ਆ ਅਤੇ ਸ਼ਹੀਦਾਂ ਨੂੰ ਯਾਦ ਕਰਦੇ ਆ ਅਤੇ ਮੇਰੀ ਬਚਪਨ ਦੀ ਯਾਦ ਦੇ ਵਿੱਚ ਇੱਕ ਹੈ ਨਾ ਅਸੀਂ ਟਰਾਲੀ ਦੇ ਵਿੱਚ ਜਾਂਦੇ ਹੁੰਦੇ ਸੀਗੇ ਅਸੀਂ ਆਪਣੇ ਪਿੰਡ ਤੋਂ ਅਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਟਰਾਲੀ ਦੇ ਵਿੱਚ ਜਾਣਾ ਅਤੇ ਜਾਂਦੇ ਜਾਂਦੇ ਟਾਈਮ ਹੈ ਨਾ ਕੀਰਤਨ ਕਰਦੇ ਜਾਣਾ ਭਜਨ ਗਾਉਂਦੇ ਜਾਣਾ